ਹਾਂਜੀ ਮੈਂ ਕਈ ਗਾਇਕਾਂ ਨੂੰ ਲਾਈਵ ਗਾਉਂਦੇ ਹੋਏ ਸੁਣਿਆ ਹੈ ਜਿਵੇਂ ਮੇਰੇ ਬਚਪਨ ਵਿੱਚ ਮੈਂ ਗੁਰਦਾਸ ਮਾਨ ਸਾਹਿਬ ਨੂੰ ਇੱਕ ਪ੍ਰੋਗਰਾਮ ਵਿੱਚ ਗਾਉਂਦੇ ਹੋਏ ਸੁਣਿਆ ਸੀ ਉਹਨਾਂ ਦੀ ਗਾਇਕੀ ਨੱਚਣ ਦਾ ਅੰਦਾਜ਼ ਅਤੇ ਉਹਨਾਂ ਦੇ ਗੀਤਾਂ ਨੇ ਮੈਨੂੰ ਕੀ ਸਾਰੇ ਸਰੋਤਿਆਂ ਨੂੰ ਹੀ ਕੀਲ ਲਿਆ ਸੀ ਉਹਨਾਂ ਦਾ ਗੀਤ ਕੀ ਬਣੂ ਦੁਨੀਆਂ ਦਾ ਤਾਂ ਮੈਨੂੰ ਅੱਜ ਤੱਕ ਵੀ ਯਾਦ ਹੈ ਜੋ ਹਾਲ ਅਸੀਂ ਆਪਣੇ ਕਲਚਰ ਦਾ ਅੱਜ ਵੇਖ ਰਹੇ ਹਾਂ ਉਹ ਮਾਨ ਸਾਹਿਬ ਨੇ ਤੀਹ ਪੈਂਤੀ ਸਾਲ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਸੀ ਉਹਦੇ ਬਾਰੇ ਕਿ ਇੱਕ ਆਉਣ ਵਾਲਾ ਸਮਾਂ ਜਿਹੜਾ ਹੈ ਕਿਸ ਤਰ੍ਹਾਂ ਦਾ ਹੋਵੇਗਾ ਮਾਨ ਸਾਹਿਬ ਨੇ ਆਪਣੇ ਗੀਤ ਵਿੱਚ ਉਦੋਂ ਹੀ ਦੱਸ ਦਿੱਤਾ ਸੀ ਜੇ ਆਪਾਂ ਅਜੋਕੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੀ ਗਾਇਕੀ ਵਿੱਚ ਪਹਿਲਾਂ ਵਾਲੀ ਸਾਦਗੀ ਸੰਜੀਦਗੀ ਨਹੀਂ ਹੈ ਪਰ ਸਤਿੰਦਰ ਸਰਤਾਜ ਜੀ ਦੇ ਗੀਤ ਸੁਣਨ ਤੋਂ ਬਾਅਦ ਮੇਰੀ ਇਹ ਧਾਰਨਾ ਵੀ ਬਦਲ ਗਈ ਕਿਉਂਕਿ ਸਾਰੇ ਕਲਾਕਾਰ ਇੱਕੋ ਜਿਹੇ ਨਹੀਂ ਹੁੰਦੇ ਸਤਿੰਦਰ ਸਰਤਾਜ ਦੇ ਗੀਤ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹਨ ਉਹਨਾਂ ਦੇ ਗੀਤ ਉਡਾਰੀਆਂ ਕਸੀਦਾ ਮਤਵਾਲਿਆ ਮੈਂ ਤੇ ਮੇਰੀ ਜਾਨ ਰੁਤਬਾ ਆਦਿ ਬਹੁਤ ਹੀ ਜ਼ਿਆਦਾ ਪਸੰਦ ਹਨ ਕੁਝ ਮਹੀਨੇ ਪਹਿਲਾਂ ਸਤਿੰਦਰ ਸਰਤਾਜ ਸਾਹਿਬ ਹੋਰੀ ਸਾਡੇ ਸ਼ਹਿਰ ਪ੍ਰੋਗਰਾਮ ਲਈ ਆਏ ਸਨ ਜਿਸ ਵਿੱਚ ਉਹਨਾਂ ਨੇ ਲਾਈਵ ਪ੍ਰੋਗਰਾਮ ਪੇਸ਼ ਕੀਤਾ ਸੀ ਜਿਸ ਵਿੱਚ ਕਿ ਮੈਂ ਕਿਸੇ ਕਾਰਣ ਕਰਕੇ ਸ਼ਾਮਿਲ ਨਾ ਹੋ ਸਕੀ ਮੇਰੇ ਦਿਲੀ ਇੱਛਾ ਹੈ ਕਿ ਮੈਂ ਉਹਨਾਂ ਨੂੰ ਲਾਈਵ ਗਾਉਂਦੇ ਹੋਏ ਸੁਣਾ ਅਤੇ ਵੇਖਾਂ ਕਿਉਂਕਿ ਉਹਨਾਂ ਦੀ ਜਿਹੜੀ ਗਾਇਕੀ ਹੈ ਉਹਦੇ ਵਿੱਚ ਸਥਿਰਤਾ ਗੰਭੀਰਤਾ ਅਤੇ ਰੂਹਾਨੀਅਤ ਝਲਕਦੀ ਹੈ ਜੋ ਕਿ ਆਮ ਗਾਇਕਾਂ ਵਿੱਚ ਨਹੀਂ ਮਿਲਦੀ ਮੈਂ ਚਾਹੁੰਦੀ ਹਾਂ ਕਿ ਸਤਿੰਦਰ ਸਰਤਾਜ ਸਾਹਿਬ ਤੰਦਰੁਸਤ ਰਹਿਣ ਹੱਸਦੇ ਵੱਸਦੇ ਰਹਿਣ ਅਤੇ ਹਮੇਸ਼ਾ ਹੀ ਇਸ ਤਰ੍ਹਾਂ ਹੀ ਸਾਡੇ ਲਈ ਚੰਗੇ ਚੰਗੇ ਗੀਤ ਗਾਉਂਦੇ ਰਹਿਣ